ਹਾਂਜੀ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਚਾਹੇ ਉਹ ਵਿਆਹ ਲੈ ਲਉ ਚਾਹੇ ਕੋਈ ਤਿਉਹਾਰ ਲੈ ਲਉ ਬੜਾ ਮਸ਼ਹੂਰ ਜਿਹੜਾ ਮੰਨਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਅਤੇ ਜਿਵੇਂ ਵਿਆਹ ਦੀ ਗੱਲ ਕਰਦੀ ਹਾਂ ਤਾਂ ਵਿਆਹ ਜਿਹੜਾ ਹੈ ਪਹਿਲੇ ਟਾਈਮ ਦੇ ਵਿੱਚ ਹੈ ਬਹੁਤ ਲੰਬਾ ਚੱਲਦਾ ਸੀ ਹੁਣ ਹੌਲੀ ਹੌਲੀ ਸਮੇਂ ਦੇ ਨਾਲ ਜਿਹੜਾ ਆ ਉਹ ਸ਼ੋਰਟ ਹੋ ਗਿਆ ਹੈ ਸਭ ਤੋਂ ਪਹਿਲਾਂ ਜਿਵੇਂ ਵਿਆਹ ਦੀਆਂ ਕੁਝ ਰਸਮਾਂ ਇਹੋ ਜਿਹੀਆਂ ਹੁੰਦੀਆਂ ਸੀਗੀਆਂ ਕਿ ਜਿਵੇਂ ਜੇਕਰ ਲੜਕੀ ਦਾ ਵਿਆਹ ਹੈ ਜਾਂ ਲੜਕੇ ਦਾ ਹੈ ਤਾਂ ਉਹਨੂੰ ਮਾਂਝੇ ਪਾਉਣਾ ਕਿਹਾ ਜਾਂਦਾ ਸੀ ਮਾਂਜੇ ਪਾਉਣਾ ਦਾ ਅਰਥ ਹੁੰਦਾ ਸੀ ਕਿ ਉਸਨੂੰ ਕੋਈ ਜ਼ਿਆਦਾ ਵਧੀਆ ਸੂਟ ਸਾਟ ਪਾਉਣ ਲਈ ਨਹੀਂ ਦਿੱਤੇ ਜਾਂਦੇ ਸੀ ਸਿਰ ਸੁਰ ਨਹੀਂ ਉਹਦਾ ਕਹਿੰਦੇ ਸੀ ਵਾਹੁਣਾ ਕਿਉਂਕਿ ਵਿਆਹ ਵਾਲੇ ਦਿਨ ਉਹਦਾ ਜ਼ਿਆਦਾ ਰੂਪ ਚੜਦਾ ਆ ਇਸ ਤੋਂ ਇਲਾਵਾ ਮਤਲਬ ਕਿ ਘਰ ਦੇ ਵਿੱਚ ਜਿਵੇਂ ਰੋਟੀ ਦਾ ਚੁੱਲੇ ਨੇਦ ਜਿਹਨੂੰ ਕਿਹਾ ਜਾਂਦਾ ਸੀ ਜਿਉਂ ਤੋਂ ਮਤਲਬ ਕਿ ਵਿਆਹ ਸ਼ੁਰੂ ਹੋ ਜਾਂਦਾ ਸੀ ਤਾਂ ਉਹਨਾਂ ਦੇ ਜਿਹੜੇ ਚਾਚੇ ਤਾਏ ਨੇ ਜਾਂ ਆਂਢ ਗੁਆਂਡ ਨੇ ਉਹਨਾਂ ਦੇ ਘਰ ਵਿੱਚ ਰੋਟੀ ਨਹੀਂ ਸੀ ਪੱਕਦੀ ਉਹ ਸਿਰਫ਼ ਵਿਆਹ ਵਾਲੇ ਘਰ ਹੀ ਪੱਕਦੀ ਸੀ ਅਤੇ ਉੱਧਰੋਂ ਹੀ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਦੂਜੇ ਘਰਾਂ ਵਿੱਚ ਜਾਂਦੀਆਂ ਸੀਗੀਆਂ ਫਿਰ ਗੀਤ ਦਾ ਬਿਠਾਉਣਾ ਜਿਵੇਂ ਅੱਜ ਕੱਲ੍ਹ ਲੇਡੀ ਸੰਗੀਤ ਹੈ ਪੈਲਸਾਂ ਦੇ ਵਿੱਚ ਸ਼ੁਰੂ ਹੋ ਗਿਆ ਉਸ ਸਮੇਂ ਜਿਹੜਾ ਆ ਲੋਕਾਂ ਦੇ ਘਰ ਜਾ ਕੇ ਰਾਤ ਨੂੰ ਜਨਾਨੀਆਂ ਜਿਹੜੀਆਂ ਨੇ ਘਰਾਂ ਦੀਆਂ ਰਾਤ ਜਾਂਦੀਆਂ ਸੀ ਅਤੇ ਚਾਰ ਚਾਰ ਪੰਜ ਪੰਜ ਘੰਟੇ ਉੱਥੇ ਗੀਤ ਗਾਉਂਦੀਆਂ ਸੀ ਤਿੰਨ ਚਾਰ ਦਿਨ ਇਹ ਲਗਾਤਾਰ ਜਿਹੜਾ ਆ ਉਹ ਕਾਰਿਆ ਕਰਮ ਜਿਹੜਾ ਚੱਲਦਾ ਸੀਗਾ ਉਸ ਤੋਂ ਬਾਅਦ ਵਿਆਹ ਦੀ ਵਾਰੀ ਆ ਜਾਂਦੀ ਸੀ ਅਤੇ ਵਿਆਹ ਅਤੇ ਵਿਆਹ ਵਾਲੇ ਦਿਨ ਵੀ ਬਹੁਤ ਸਾਰੀਆਂ ਜਿਹੜੀਆਂ ਵਾ ਉਹ ਜਿਹੜੀਆਂ ਕੀਤੀਆਂ ਜਾਂਦੀਆਂ ਸੀਗੀਆਂ ਰਸਮਾਂ ਤੇ ਉਹ ਬੜੀਆਂ ਲੰਬੀਆਂ ਚੱਲਦੀਆਂ ਸੀਗੀਆਂ ਜਿਵੇਂ ਨਹਾਉਣ ਤੋਂ ਪਹਿਲਾਂ ਗੁੱਤ ਦਾ ਖੋਲ੍ਹਣਾ ਮਿੱਡੀ ਦਾ ਖੋਲ੍ਹਣਾ ਤੇਲ ਚੜਾਉਣਾ ਜਿਵੇਂ ਸਹੇਲੀਆਂ ਇਕੱਠੀਆਂ ਹੋ ਕੇ ਕੁੜੀਆਂ ਦੀ ਗੁੱਤ ਖੋਲ੍ਹਦੀਆਂ ਸੀਗੀਆਂ ਬਾਅਦ 'ਚ ਉਹਨਾਂ ਨੂੰ ਤੇਲ ਚੜ੍ਹਾਉਂਦੇ ਸੀ ਹਲਦੀ ਲਾਉਂਦੇ ਸੀਗੇ ਉਹਨਾਂ ਦੇ ਗਾਨੇ ਬੰਨਦੇ ਸੀਗੇ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਹੌਲੀ ਹੌਲੀ ਜਿਹੜੀਆਂ ਰਸਮਾਂ ਜਿਹੜੀਆਂ ਹੈ ਉਹ ਘੱਟਦੀਆਂ ਗਈਆਂ ਪਰ ਅਗਰ ਆਪਾਂ ਤਾਂ ਸ਼ੁਰੂ ਕਰ ਦਈਏ ਤਾਂ ਫਿਰ ਤਾਂ ਬਹੁਤ ਲੰਬੀ ਗੱਲ ਚੱਲੇਗੀ ਪਰ ਤੇਲ ਚੜਾਉਣਾ ਡੋਲੀ 'ਚ ਬਿਠਾਉਣਾ ਸਿੱਖਿਆ ਪੜ੍ਹਨੀ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਵਾ ਉਹ ਵਿਆਹ ਦੇ ਵਿੱਚ ਹੁੰਦੀਆਂ ਸੀਗੀਆਂ ਰਸਮਾਂ ਜੋ ਕਿ ਪੰਜਾਬੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਅੰਗ ਆ ਧੰਨਵਾਦ